ਪੰਜਾਬ ਦੇ ਵਿੱਚ ਜਿਹੜਾ ਖ਼ਾਸ ਤੌਰ 'ਤੇ ਜੇ ਮੈਂ ਦੱਸਾਂ ਜੇ ਸ਼ੋਸ਼ਲ ਮੀਡੀਆ ਦੀ ਗੱਲ ਕੀਤੀ ਜਾਵੇ ਤਾਂ ਬਹੁਤ ਵੱਡਾ ਪਲੈਟਫਾਰਮ ਹੈ ਔਨਲਾਈਨ ਸ਼ੋਸ਼ਲ ਮੀਡੀਆ ਦੋਨੋਂ ਹੀ ਕਿਉਂ ਕਿਉਂਕਿ ਔਨਲਾਈਨ ਮਤਲਬ ਜਿਹੜੇ ਲੋਕ ਬਹੁਤ ਜ਼ਿਆਦਾ ਅਰਨਿੰਗ ਕਰ ਰਹੇ ਕਿਵੇਂ ਅਰਨਿੰਗ ਕਰ ਰਹੇ ਹੈ ਉਹ ਸਿਰਫ਼ ਵੀ ਮਤਲਬ ਕਮਾ ਕੇ ਕਿੱਥੋਂ ਕਮਾ ਕੇ ਵੀ ਇੰਸਟਾਗ੍ਰਾਮ ਦੇ ਜਰੀਏ ਯੂਟਿਊਬ ਦੇ ਜਰੀਏ ਠੀਕ ਹੈ ਫੇਸਬੁੱਕ ਦੇ ਜਰੀਏ ਉਹ ਆਪਣਾ ਹਾਸ ਰਸ ਆਪਣੇ ਚੁਟਕਲੇ ਲੋਕਾਂ ਤੱਕ ਪਹੁੰਚਾਉਂਦੇ ਨੇ ਅਤੇ ਫਿਰ ਉਸ ਤੋਂ ਬਾਅਦ ਉਹਨਾਂ ਨੂੰ ਉਸ ਹਿਸਾਬ ਨਾਲ ਜਿੱਦਾਂ ਉਹਨਾਂ ਦੇ ਵਿਊਸ ਆਉਂਦੇ ਆ ਉੱਨੇ ਹੀ ਪੈਸੇ ਮਿਲਦੇ ਨੇ ਅਤੇ ਤਾਂ ਕਰਕੇ ਵੀ ਮੈਨੂੰ ਇਵੇਂ ਲੱਗਦਾ ਹੈ ਵੀ ਪੰਜਾਬ ਦੇ ਵਿੱਚ ਇਹ ਚੀਜ਼ ਬਹੁਤ ਜ਼ਿਆਦਾ ਪ੍ਰਚਲਿਤ ਹੋ ਰਹੀ ਹੈ ਅਤੇ ਜਿਵੇਂ ਮੈਂ ਮਤਲਬ ਯੂਟੀਊਬ 'ਤੇ ਵੈਸੇ ਤਾਂ ਫੇਸਬੁੱਕ 'ਤੇ ਮੇਰੇ ਫਾਦਰ ਮਦਰ ਹੱਸ ਹਾਸ ਰਸ ਵਾਲੀਆਂ ਸਾਰੀ ਚੀਜ਼ਾਂ ਦੇਖਦੇ ਰਹਿੰਦੇ ਹੈ ਅਤੇ ਮੈਂ ਯੂਟੀਊਬ 'ਤੇ ਕੋਈ ਬੱਸੀ ਕਰਕੇ ਨਾਮ ਹੈ ਮੈਨੂੰ ਹੁਣ ਨਾਮ ਇੱਕ ਦਮ ਯਾਦ ਨਹੀਂ ਆ ਰਿਹਾ ਦੋ ਤਿੰਨ ਜਾਣੇ ਆ ਜਿਹੜੇ ਸਟੈਂਡ ਅਪ ਕਮੇਡੀਅਨ ਦਾ ਅੱਜ ਕੱਲ੍ਹ ਕਿੰਨਾ ਜ਼ਿਆਦਾ ਰਿਵਾਜ਼ ਚਲ ਗਿਆ ਉਹ ਭਾਅ ਜੀ ਭਾਅ ਜੀ ਵਾਲਾ ਵੀ ਹੈਗਾ ਕੋਈ ਅਤੇ ਉਹ ਵੀ ਮਤਲਬ ਉਹ ਕਰਦੇ ਹੈ ਇੰਸਟਾਗਰਾਮ 'ਤੇ ਵੀਡੀਓਜ ਪਾਉਂਦੇ ਹੈ ਯੂਟੀਊਬ 'ਤੇ ਵੀਡੀਓਜ ਪਾਉਂਦੇ ਹੈ ਅਤੇ ਉਹਦੇ ਨਾਲ ਕੀ ਹੁੰਦਾ ਫਿਰ ਉਹ ਪੈਸਾ ਕਮਾਉਂਦੇ ਅਤੇ ਬਹੁਤ ਵਧੀਆ ਗੱਲ ਕਰਦੇ ਹਨ ਉਹ ਅੱਜ ਕੱਲ੍ਹ ਦੀ ਜਨਰੇਸ਼ਨ ਦੇ ਅਕੋਰਡਿੰਗ ਗੱਲ ਕਰਦੇ ਹੈ ਅਤੇ ਜਿਸ ਨਾਲ ਐਵੇਂ ਹੁੰਦਾ ਵੀ ਮਜ਼ਾ ਆਉਂਦਾ ਮਤਲਬ ਐਵੇਂ ਪਤਾ ਨਹੀਂ ਲੱਗਦਾ ਵੀ ਇੰਨਾ ਟਾਈਮ ਕਿਵੇਂ ਬੀਤ ਗਿਆ ਜਿਹੜਾ ਮੈਨੂੰ ਇੱਕ ਵੀਡੀਓ ਯਾਦ ਹੈ ਜਿਹੜੀ ਮੈਂ ਦੋ ਤਿੰਨ ਵਾਰ ਦੇਖ ਚੁੱਕੀ ਮਤਲਬ ਹਾਸ ਰਸ ਐਵੇਂ ਹੈ ਵੀ ਇਹ ਚੀਜ਼ ਆਪਾਂ ਨੂੰ ਸਟਰੈਸ ਦੂਰ ਕਰਦੀ ਹੈ ਵੀ ਮੰਨੋਰੰਜਨ ਦਾ ਕੋਈ ਵੀ ਜਿਹੜਾ ਜਰੀਆ ਹੈਗਾ ਇੱਕ ਜਸਪ੍ਰੀਤ ਸਿੰਘ ਕਰਕੇ ਮੁੰਡਾ ਹੈਗਾ ਮਤਲਬ ਦਿੱਲੀ ਦਾ ਮੁੰਡਾ ਸ਼ਾਇਦ ਉਹ ਅਤੇ ਉਹ ਪੰਜਾਬੀ ਮਤਲਬ ਹਿੰਦੀ ਵਿੱਚ ਕਰਦਾ ਕੋਮੇਡੀ ਅਤੇ ਉਹ ਕਾਫੀ ਜ਼ਿਆਦਾ ਹਾਸੇ ਵਾਲੀ ਗੱਲਾਂ ਕਰਦਾ ਮਤਲਬ ਕਾਫੀ ਉਹਦੇ ਜਿਹੜੇ ਪ੍ਰੋਗਰਾਮ ਚੱਲਦੇ ਹੈ ਤਾਂ ਮਤਲਬ ਵੀ ਅੱਜ ਕੱਲ੍ਹ ਰੁਜ਼ਗਾਰ ਦਾ ਸਾਧਨ ਹੋ ਚੁੱਕੇ ਹੈ ਜੋ ਮੰਨੋਰੰਜਨ ਦੇ ਪ੍ਰੋਗਰਾਮ ਹੈ ਸ਼ੋਸ਼ਲ ਮੀਡੀਆ ਤੋਂ ਹਰ ਹਰ ਇਨਸਾਨ ਰੁਜ਼ਗਾਰ ਦੇਖ ਰਿਹਾ ਰੁਜ਼ਗਾਰ ਆਪਣਾ ਕਮਾਈ ਕਰ ਰਿਹਾ ਜਿੰਨੇ ਜ਼ਿਆਦਾ ਅਗਲਿਆਂ ਦੀ ਵੀਡੀਓ ਨੂੰ ਪਸੰਦ ਕੀਤਾ ਜਾਂਦਾ ਓਨੇ ਹੀ ਜ਼ਿਆਦਾ ਉਹਨਾਂ ਨੂੰ ਵਧੀਆ ਉਹ ਮਿਲਦੇ ਹੈ ਪੈਸੇ ਮਿਲਦੇ ਹੈ ਅਤੇ ਮੈਨੂੰ ਕਾਫੀ ਟਾਈਮ ਹੋ ਗਿਆ ਮੈਂ ਜਿਹੜੇ ਇਹ ਚੈਨਲਜ਼ ਦੇਖ ਰਹੀ ਹਾਂ ਅਤੇ ਇਹਨਾਂ ਨੂੰ ਮੈਂ ਲਾਈਕ ਕਰਦੀ ਹਾਂ ਪਸੰਦ ਕਰਦੀ ਹਾਂ ਇਹ ਐਦਾਂ ਹੁੰਦਾ ਕਿ ਹੋਰ ਬਾਕੀ ਫਾਲਤੂ ਦੇ ਕੰਮਾਂ ਤੋਂ ਦੂਰ ਰੱਖ ਕੇ ਇਹ ਫਾਲਤੂ ਦੇ ਕੰਮਾਂ ਤੋਂ ਦੂਰ ਰੱਖ ਕੇ ਅਤੇ ਆਪਾਂ ਨੂੰ ਮੰਨੋਰੰਜਨ ਦਾ ਸਾਧਨ ਦਿੰਦੇ ਨੇ ਥੋੜ੍ਹੀ ਪਰੇਸ਼ਾਨੀਆਂ ਤੋਂ ਬੰਦਾ ਬੱਚਦਾ ਹੈਗਾ ਵਧੀਆ ਤਰ੍ਹਾਂ ਹਾਂ ਮਤਲਬ ਜਿਹੜਾ ਵੀ ਕੋਮੇਡੀ ਕਰਦਾ ਪੰਜਾਬੀ ਵਿੱਚ ਕਰਦਾ ਹਿੰਦੀ ਵਿੱਚ ਹੈ ਜਿਹੜੀ ਭਾਸ਼ਾ ਆਪਾਂ ਨੂੰ ਸਮਝ ਆਉਂਦੀ ਹੈ ਉਹ ਭਾਸ਼ਾ ਜ਼ਿਆਦਾ ਬੈਟਰ ਹੁੰਦੀ ਹੈ ਉਹਦੇ ਵਿੱਚ ਹੀ ਆਪਾਂ ਹੱਸ ਆਪਾਂ ਉਸੀ ਭਾਸ਼ਾ 'ਚ ਸਕਦੇ ਜਿਹੜੇ ਆਪਾਂ ਨੂੰ ਚੰਗੀ ਤਰ੍ਹਾਂ ਸਮਝ ਆ ਰਹੀ ਹੋਵੇ ਅਤੇ ਕਾਫੀ ਜ਼ਿਆਦਾ ਮੇਰਾ ਜਿਹੜਾ ਐਕਸਪੀਰੀਐਂਸ ਆ ਉਹ ਔਨਲਾਈਨ ਕਰਨ ਦਾ ਵਧੀਆ ਰਹਿੰਦਾ ਹੈਗਾ ਅਤੇ ਹੱਸਦੇ ਰਹਿਣਾ ਚਾਹੀਦਾ ਜਿਵੇਂ ਟੈਂਸ਼ਨਾਂ ਨੂੰ ਥੋੜ੍ਹੀ ਦੇਰ ਲਈ ਮਤਲਬ ਕੰਮ ਕੰਮ ਕੰਮ ਵਾਲੇ ਕੰਮ ਨੂੰ ਥੋੜ੍ਹੀ ਦੇਰ ਲਈ ਦੂਰ ਕਰਕੇ ਨਾ ਹੱਸਦੇ ਰਹਿਣਾ ਚਾਹੀਦਾ ਹੈਗਾ ਆਪਾਂ ਨੂੰ ਵੀ ਮੰਨੋਰੰਜਨ ਦੇ ਸਾਧਨ ਲੱਭਣੇ ਚਾਹੀਦੇ ਨੇ ਅੱਜ ਕੱਲ੍ਹ ਤਾਂ ਸ਼ੋਸ਼ਲ ਮੀਡੀਆ ਦਾ ਟਾਈਮ ਹੈ ਬਹੁਤ ਕੁਛ ਹੈ ਵੀ ਹਰ ਚੀਜ਼ ਵਧੀਆ ਚੱਲ ਰਹੀ ਹੈ ਅਤੇ ਇਸ ਚੀਜ਼ ਦੇ ਨਾਲ ਇਹ ਹੁੰਦਾ ਵੀ ਆਪਣਾ ਜਿਹੜਾ ਸਮਾਂ ਉਹ ਥੋੜ੍ਹਾ ਜਿਹਾ ਕੁਛ ਹਾਸੇ ਪਲ ਵਿੱਚ ਬਤੀਤ ਹੋ ਜਾਂਦਾ ਪਰਿਵਾਰਿਕ ਹਾਸੇ ਮਜ਼ਾਕ ਵਾਲੀਆਂ ਚੀਜ਼ਾਂ ਦੇਖਣੀਆਂ ਚਾਹੀਦੀਆਂ ਆਪਾਂ ਨੂੰ ਹੋਰ ਮੰਨੋਰੰਜਨ ਦੇ ਸਾਧਨ ਸਰਕਸ ਹੋ ਜਾਂਦੀ ਹੈ ਮੇਲੇ ਵਗੈਰਾ ਦੇ ਵਿੱਚ ਪਰ ਜਿਹੜੇ ਔਨਲਾਈਨ ਨੇ ਅੱਜ ਕੱਲ੍ਹ ਤਾਂ ਲੋਕ ਘਰ ਬੈਠੇ ਹੀ ਠੰਡ ਦੇ ਮੌਸਮ ਵਿੱਚ ਭਾਲਦੇ ਨੇ ਵੀ ਵਧੀਆ ਤਰ੍ਹਾਂ ਵੀ ਆਪਾਂ ਨੂੰ ਹਾਸ ਰਸ ਦੇ ਸਾਧਨ ਮਿਲ ਜਾਣ ਜੀ ਧੰਨਵਾਦ